ਹਾਂਜੀ ਸਤਿ ਸ਼੍ਰੀ ਅਕਾਲ਼ ਜੀ ਅੱਛਾ ਅੱਛਾ ਰੇਨੂ ਸ਼ਰਮਾ ਹਾਂਜੀ ਹਾਂਜੀ ਜਾਣਦੀ ਹੈ ਅੱਛਾ ਜੀ ਅੱਛਾ ਜੀ ਹਾਂਜੀ ਹਾਂਜੀ ਪਟਿਆਲਾ ਦੇ ਵਿੱਚ ਵੀ ਵੈਸੇ ਤਾਂ ਬਹੁਤ ਅੱਛੀਆਂ ਅੱਛੀਆਂ ਸ਼ੋਪਸ ਨੇ ਜੇ ਤੁਸੀਂ ਤ੍ਰਿਪੜੀ ਵਾਲੀ ਸਾਈਡ 'ਤੇ ਚਲੇ ਜਾਓ ਤਾਂ ਤੁਹਾਨੂੰ ਬਹੁਤ ਅੱਛੇ ਅੱਛੇ ਸ਼ੋਅਰੂਮਜ਼ ਮਿਲਣਗੇ ਸ਼ੌਪ ਨੇ ਹੈ ਨਾ ਰੀਜਨੇਬਲ ਰੇਟ ਵਾਲੀਆਂ ਵੀ ਨੇ ਉਹ ਤੁਸੀਂ ਆਪਣੇ ਹੀ ਰੇਂਜ ਦੇ ਹਿਸਾਬ ਨਾਲ ਡਿਸਾਈਡ ਕਰ ਸਕਦੇ ਹੋ ਕਿ ਤੁਸੀਂ ਕਿਸ ਤਰ੍ਹਾਂ ਦੀ ਲੈਣੀ ਹੈ ਪਰ ਲੋਕਲ ਉੱਥੇ ਬਣਾਉਂਦੇ ਨੇ ਉਹਨਾਂ ਦੀ ਜਿਹੜੀ ਵਰਕਸ਼ੌਪਸ ਹੈ ਉਹ ਵੀ ਨੇੜੇ ਨੇੜੇ ਨੇ ਤੁਸੀਂ ਕੁਛ ਡਿਜ਼ਾਇਨ ਆਪਣੇ ਹਿਸਾਬ ਨਾਲ ਕਸਟਮਾਈਜ਼ ਕਰਵਾਣਾ ਚਾਹੁੰਦੇ ਹੋ ਕਰਦੇ ਆ ਫੁਲਕਾਰੀਆਂ ਦੇ ਲਈ ਦੋਨੋਂ ਤਰ੍ਹਾਂ ਦੀਆਂ ਹੁੰਦੀਆਂ ਨੇ ਉਹਨਾਂ ਕੋਲ ਹੱਥ ਦੀਆਂ ਵੀ ਅਤੇ ਮਸ਼ੀਨੀ ਵੀ ਹੱਥ ਵਾਲੀ ਥੋੜ੍ਹੀ ਕੋਸਟਲੀ ਪੈ ਜਾਂਦੀ ਹੈ ਅਤੇ ਜਿਹੜੀ ਮਸ਼ੀਨੀ ਹੁੰਦੀ ਆ ਉਹ ਥੋੜ੍ਹੀ ਸਸਤੀ ਰੇਟ ਦੇ ਵਿੱਚ ਵੇਰੀਏਸ਼ਨ ਹੁੰਦੀ ਹੈ ਮੈਂ ਅੰਮ੍ਰਿਤਸਰ ਵਿਜ਼ਿਟ ਕੀਤਾ ਸੀ ਉੱਥੇ ਵੀ ਮੈਨੂੰ ਬਹੁਤ ਅੱਛੀ ਰੇਂਜ ਮਿਲੀ ਸੀਗੀ ਉੱਥੇ ਵੀ ਬਹੁਤ ਵਧੀਆ ਨੇ ਤੁਸੀਂ ਅੰਮ੍ਰਿਤਸਰ ਵੀ ਟਰਾਈ ਕਰ ਸਕਦੇ ਓਂ ਹਾਂਜੀ ਪਟਿਆਲਾ ਦੇ ਵਿੱਚ ਜਿਹੜਾ ਤੋਪਖਾਨਾ ਮੋੜ ਹੈ ਉੱਥੇ ਕਾਫੀ ਸਾਰੀ ਪੰਜਾਬੀ ਜੁੱਤੀਆਂ ਦੀਆਂ ਦੁਕਾਨਾਂ ਨੇ ਇੱਕ ਦਾਤਾ ਪੰਜਾਬੀ ਜੁੱਤੀ ਸਟੋਰ ਹੈ ਉਹਨਾਂ ਦੇ ਕੋਲ ਕਾਫੀ ਅੱਛੀ ਰੇਂਜ ਹੈ ਅਤੇ ਤੁਸੀਂ ਉੱਥੋਂ ਟਰਾਈ ਕਰ ਸਕਦੇ ਓਂ ਹਾਂਜੀ ਥੈਂਕ ਯੂ ਜੀ